ਹੈਲੋ ਮੈਂ ਨਵਨੀਤ ਗੱਲ ਕਰ ਰਹੀ ਹਾਂ ਤੁਸੀਂ ਓਲਾ ਤੋਂ ਗੱਲ ਕਰ ਰਹੇ ਹੋ ਮੈਂ ਰੋਪੜ ਰਹਿੰਦੀ ਹਾਂ ਅਤੇ ਮੈਨੂੰ ਬੇਲਾ ਚੌਂਕ ਤੱਕ ਤੁਹਾਡੀ ਕੈਬ ਜਾਂ ਆਟੋ ਚਾਹੀਦਾ ਸੀ ਅਤੇ ਕਿਆ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਮੈਨੂੰ ਉਪਲਬਧ ਕਰਵਾ ਕੇ ਦੇ ਸਕਦੇ ਹੋ ਅਤੇ ਕਿੰਨੇ ਤੁਹਾਡੇ ਚਾਰਜਿਸ ਹੋਣਗੇ ਅਤੇ ਮੈਨੂੰ ਸਿਰਫ ਅੱਧੇ ਕੁ ਘੰਟੇ ਦਾ ਕੰਮ ਹੈ ਅਤੇ ਅਗਰ ਤੁਸੀਂ ਮੈਨੂੰ ਮੇਰੇ ਕੋਲ ਕੈਬ ਵਾਲਾ ਜਾਂ ਆਟੋ ਵਾਲਾ ਜੋ ਵੀ ਹੈ ਉਹ ਢਾਈ ਵਜੇ ਤੱਕ ਭੇਜ ਦਿੰਦੇ ਹੋ ਤਾਂ ਤਿੰਨ ਵਜ਼ੇ ਆਪਾਂ ਚੱਲ ਪਵਾਂਗੇ ਤਾਂ ਮੈਂ ਚਾਰ ਜਾਂ ਪੰਜ ਵਜ਼ੇ ਤੱਕ ਤੁਹਾਨੂੰ ਕੈਬ ਵਾਲਾ ਵਿਹਲਾ ਕਰਕੇ ਦੇ ਦੇਵਾਂਗੀ ਮੈਨੂੰ ਤੁਸੀਂ ਜਿਹੜੀ ਕੈਬ ਦਿਓਗੇ ਉਹ ਮੈਨੂੰ ਵਾਪਸੀ 'ਤੇ ਕਿਆ ਇਹ ਹੋ ਸਕਦਾ ਹੈ ਕਿ ਉਹ ਤੁਸੀਂ ਮੈਨੂੰ ਕੈਬ ਜੋ ਦੇ ਰਹੇ ਹੋ ਉਹ ਪਹਿਲਾਂ ਮੈਨੂੰ ਘਰ ਤੋਂ ਲੈ ਕੇ ਬੇਲਾ ਚੌਂਕ ਤੱਕ ਛੱਡ ਦੇਵੇ ਅਤੇ ਉਸ ਤੋਂ ਬਾਅਦ ਮੇਰਾ ਕੰਮ ਹੋਣ ਤੋਂ ਬਾਅਦ ਬੇਲਾ ਚੌਂਕ ਤੋਂ ਘਰ ਵਾਪਸੀ ਤੱਕ ਵੀ ਛੱਡ ਦੇਵੇ ਅਤੇ ਕੀ ਅਗਰ ਕੋਈ ਆਫਰ ਵਗੈਰਾ ਅਵੇਲੇਵਲ ਹੈ ਤਾਂ ਤੁਸੀਂ ਮੈਨੂੰ ਕਿਆ ਉਹ ਵੀ ਦੱਸ ਸਕਦੇ ਹੋ ਕੋਈ ਆਟੋ ਕੋਈ ਕੈਬ ਜਾਂ ਕੁਛ ਵੀ ਜੋ ਵੀ ਅਵੇਲੇਵਲ ਹੈ ਪਲੀਜ਼ ਤੁਸੀਂ ਕਿਆ ਮੈਨੂੰ ਦੱਸ ਸਕਦੇ ਹੋ ਅਤੇ ਤੁਸੀਂ ਮੈਨੂੰ ਚਾਰਜਿਸ ਵੀ ਨਾਲ ਹੀ ਦੱਸ ਦਿਓ ਕਿ ਕਿੰਨੇ ਚਾਰਜਿਸ ਲੱਗਣਗੇ ਕਿਉਂਕਿ ਕੋਈ ਬ ਕੋਈ ਵੀ ਬੇਲ ਮੇਰੇ ਘਰ ਤੋਂ ਲੈ ਕੇ ਬੇਲਾ ਚੌਂਕ ਤੱਕ ਕੋਈ ਵੀ ਬੱਸ ਤਾਂ ਜਾਂਦੀ ਨਹੀਂ ਹੈ ਇਸ ਲਈ ਮੈਨੂੰ ਤੁਹਾਡੀ ਕੈਬ ਜਾਂ ਤੁਹਾਡੀ ਆਟੋ ਚਾਹੀਦਾ ਸੀ